ਤੇਈ ਮਾਰਚ ਉੱਨੀ ਸੌ ਛਿਆਸੀ ਸਤਾਈ ਜੂਨ ਉੱਨੀ ਸੌ ਬਾਨਵੇਂ ਤਿੰਨ ਜਨਵਰੀ ਉੱਨੀ ਸੌ ਸਤਾਨਵੇਂ ਚੌਦਾਂ ਅਗਸਤ ਦੋ ਹਜ਼ਾਰ ਅੱਠ ਪੱਚੀ ਦਸੰਬਰ ਦੋ ਹਜ਼ਾਰ ਵੀਹ